ਸਰਕਾਰੀ ਸਕੀਮ ਦੇ ਵਿੱਚ ਜਿਵੇਂ ਕਿ ਪੰਜਾਬ ਰਾਜ ਦੇ ਵਿੱਚ ਬਿਜਲੀ ਹੈ ਜਿਹੜੀ ਉਹ ਛੇ ਸੌ ਯੂਨਿਟ ਇੱਕ ਘਰ ਨੂੰ ਮੁਫਤ ਦਿੱਤੀ ਜਾਂਦੀ ਹੈ ਇਹਦੇ ਨਾਲ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਸਹਾਇਤਾ ਪ੍ਰਾਪਤ ਹੋਈ ਹੈ ਕਿਉਂਕਿ ਉਹਨਾਂ 'ਤੇ ਆਰਥਿਕ ਬੋਝ ਘਟਿਆ ਹੈ ਜਿਹੜਾ ਕਿ ਉਹ ਬਿੱਲ ਦੇ ਰੂਪ ਦੇ ਵਿੱਚ ਉਹਨਾਂ 'ਤੇ ਬੋਝ ਪੈਂਦਾ ਸੀ ਇਸ ਤੋਂ ਇਲਾਵਾ ਉਹ ਹੁਣ ਇਹ ਖਿਆਲ ਰੱਖਦੇ ਨੇ ਕਿ ਛੇ ਸੌ ਯੂਨਿਟ ਤੋਂ ਅਸੀਂ ਘੱਟ ਹੀ ਯੂਨਿਟ ਜਿਹੜੇ ਖਰਚ ਕਰੀਏ ਤਾਂ ਕਿ ਸਾਨੂੰ ਬਿੱਲ ਨਾ ਆਵੇ ਇਸ ਦੇ ਨਾਲ ਹੀ ਬਿਜਲੀ ਦੀ ਬੱਚਤ ਵੀ ਹੋਈ ਹੈ ਇਹਦੇ ਨਾਲ ਇੱਕ ਪਾਸੇ ਆਰਥਿਕਤਾ ਦਾ ਬੋਝ ਲੋਕਾਂ 'ਤੇ ਘਟਿਆ ਅਤੇ ਨਾਲ ਹੀ ਦੇ ਜਿਹੜੀ ਦੇਸ਼ ਦੇ ਵਿੱਚ ਰਾਜ ਦੇ ਵਿੱਚ ਬਿਜਲੀ ਦੀ ਬੱਚਤ ਹੋਣੀ ਸ਼ੁਰੂ ਹੋਈ ਹੈ